ਆਪਣੇ ਰਾਜ ਵਿੱਚ ਮੁੱਖ ਧਾਰਮਿਕ ਸਥਾਨ ਆਪਣੇ ਹੋ ਗਏ ਅਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਅਤੇ ਆਪਣੇ ਰਾਜਾ ਸਾਹਿਬ ਅਤੇ ਮੰਦਰ ਆਪਣੇ ਹੋ ਗਏ ਮਾਤਾ ਚਿੰਤਪੁਰਨੀ ਮਾਤਾ ਜਵਾਲਾ ਜੀ ਅਤੇ ਆਪਣੇ ਪੀਰਾਂ ਦੀ ਜਗ੍ਹਾ ਹੋ ਗਈ ਆਪਣੇ ਮਢਾਲੀ ਪੀਰ ਬਾਬਾ ਜੀ ਦੀ ਜਗ੍ਹਾ ਹੋ ਗਈ ਆਪਣੇ ਆਹਾ ਬਾਬੇ ਨਗੱਜੇ ਦੀ ਗੁਣਾਚੋਰ ਜਾਂਦਿਆ ਨੂੰ ਰਸਤੇ ਬਾਬੇ ਨਗੱਜੇ ਪੀਰ ਦੀ ਜਗ੍ਹਾ ਆਉਂਦੀ ਹੈ ਉੱਥੇ ਜਿਹੜੀ ਮਰਜ਼ੀ ਮੰਨਤ ਮੰਗੋ ਹਰੇਕ ਮੰਨਤ ਪੂਰੀ ਹੁੰਦੀ ਹੈ ਓ ਉਹਦਾ ਧਾਰਮਿਕ ਸਥਾਨ ਜਿਹੜਾ ਮਤਲਬ ਟਾਈਮ ਪੀਸ ਉੱਥੇ ਟਾਈਮ ਪੀਸ ਜਿੱਦਾਂ ਚੜ੍ਹਾਏ ਜਾਂਦੇ ਜ਼ਿਆਦਾ ਨਗੱਜੇ ਬਾਬੇ ਦੀ ਜਗ੍ਹਾ 'ਤੇ ਉੱਥੇ ਜਿੱਦਾਂ ਆਪਾਂ ਕੋਈ ਰੀਝ ਪੂਰੀ ਮੰਗਦੇ ਹਾਂ ਕੋਈ ਮੰਨਤ ਮੰਗਦੇ ਹਾਂ ਆਪਣੀ ਮੰਨਤ ਪੂਰੀ ਹੁੰਦੀ ਉੱਥੇ ਬਹੁਤ ਧਾਰਮਿਕ ਜਗ੍ਹਾ ਆਪਾਂ ਨੂੰ ਗੁਣਾਚੋਰ ਜਾਂਦਿਆ ਨੂੰ ਰਸਤੇ 'ਚ ਆਉਂਦੀ ਹੈ ਧਾਰਮਿਕ ਜਗ੍ਹਾ ਪੀਰਾਂ ਦੀ ਬਾਬੇ ਪੀਰਾਂ ਦੀ ਜਗ੍ਹਾ ਉੱਥੇ ਆਪਾਂ ਜਿਹੜੀ ਮਰਜ਼ੀ ਮੰਨਤ ਮੰਗੋ ਸੱਚੇ ਦਿਲ ਨਾਲ ਉਹ ਪੂਰੀ ਹੁੰਦੀ ਹੈ ਮਤਲਬ ਇੱਥੇ ਅਤੇ ਬਾਬਾ ਮਡਾਲੀ ਬਾਬਾ ਪੀਰਾਂ ਦੀ ਜਗ੍ਹਾ ਉੱਥੇ ਵੀ ਜੋ ਸੱਚੇ ਮਨ ਨਾਲ ਮੰਗੋ ਕੋਈ ਆਪਣੀ ਮੰਨਤ ਹਰੇਕ ਮੰਨਤ ਪੂਰੀ ਕਰਦੇ ਆ ਉਹ ਆਪਣੇ ਰਾਜਾ ਸਾਹਿਬ ਇੱਕ ਸੌੌੌੌ ਅੱਠ ਸ਼੍ਰੀ ਨਾਭ ਨਾਭ ਕੰਵਲ ਰਾਜਾ ਸਾਹਿਬ ਜੀ ਮ ਮਜ਼ਾਰੇ ਰਾਏ ਸਾਹਿਬ ਜੀ ਦੇ ਮਜ਼ਾਰੇ ਪਿੰਡ ਮਜ਼ਾਰੇ ਵਿੱਚ ਸਥਾਨ ਉੱਥੇ ਜਿੱਦਾਂ ਉਹਨਾਂ ਦੀ ਉਹਨਾਂ ਦੀ ਧਾਰਮਿਕ ਧਾਰਮਿਕ ਸਥਾਨ ਜਿੱਦਾਂ ਮਤਲਬ ਚੌਵੀ ਘੰਟੇ ਲੰਗਰ ਚਲਦਾ ਉੱਥੇ ਚੌਵੀ ਘੰਟੇ ਲੰਗਰ ਚੱਲਣਾ ਅਤੇ ਕਿਸੇ ਨੂੰ ਨਾਂਹ ਨਹੀਂ ਉੱਥੇ ਜਿੱਦਾਂ ਜਿਹੜੇ ਕੁੱਤਿਆਂ ਨੂੰ ਨਾ ਕੁੱਤਿਆਂ ਨੂੰ ਕੋਈ ਇੱਥੇ ਕੁਝ ਨਹੀਂ ਕਰ ਸਕਦਾ ਕੁੱਤਿਆਂ ਨੂੰ ਜਿੱਥੇ ਮਰਜ਼ੀ ਕੁੱਤੇ ਬਹਿਣ ਅੰਦਰ ਬਹਿੰਦੇ ਕੁੱਤੇ ਅੰਦਰ ਜਾ ਕੇ ਬਹਿੰਦੇ ਆ ਕੁੱਤੇ ਜਿੱਥੇ ਮਰਜ਼ੀ ਬਹਿਣ ਕੋਲ ਕੋਈ ਉੱਥੇ ਕੁੱਤਿਆਂ ਨੂੰ ਦੂਜੀ ਨਹੀਂ ਹੈਗੀ ਸੱਚੇ ਦਿਲ ਨਾ ਮੰਗੋ ਮੰਨਤ ਹੱਥ ਜੋੜ ਕੇ ਰਾਜਾ ਸਾਹਿਬ ਜੀ ਸਾਡੀ ਹਰੇਕ ਮੰਨਤ ਪੂਰੀ ਕਰਦੇ ਆ ਠੀਕ ਆ ਸੱਚੇ ਦਿਨ ਨਾਲ ਮੰਗੋ ਅਤੇ ਆਪਾਂ ਮਾਤਾ ਦੇ ਮਾਤਾ ਦੇ ਜਾਂਦੇ ਹਾਂ ਮਾਤਾ ਚਿੰਤਪੂਰਨੀ ਦੇ ਜਾਂਦੇ ਹਾਂ ਮਾਤਾ ਜਵਾਲਾ ਜੀ ਦੇ ਜਾਂਦੇ ਹਾਂ ਸੱਚੇ ਦਿਲ ਨਾਲ ਮੰਗੋ ਜਿਹੜੀ ਮਰਜ਼ੀ ਮੰਨਤ ਮੰਗੋ ਸੱਚੇ ਦਿਲ ਨਾਲ ਮੰਗੋ ਦਿਲ ਸਾਫ ਰੱਖੋ ਸਾਫ ਰੱਖ ਕੇ ਮੰਗੋ ਜੇ ਆਪਾਂ ਕਿਸੇ ਗੁਰੂ ਦੇ ਸਥਾਨ 'ਤੇ ਜਾਂਦੇ ਆਪਣਾ ਮਨ ਸਾਫ ਰੱਖੋ ਆਪਣਾ ਦਿਲ ਸਾਫ ਰੱਖਣਾ ਚਾਹੀਦਾ ਹਰੇਕ ਆਪਣੀ ਮੰਨਤ ਪੂਰੀ ਹੁੰਦੀ ਆ ਜੇ ਆਪਾਂ ਆਪਣੇ ਦਿਲ ਮਨ 'ਚ ਮੈਲ ਰੱਖਦੇ ਹਾਂ ਕੋਈ ਗੰਦ ਰੱਖਦੇ ਹਾਂ ਕਦੇ ਆਪਣੀ ਮੰਨਤ ਪੂਰੀ ਨਹੀਂ ਹੋਈ ਕਦੇ ਵੀ ਸੱਚੇ ਦਿਲ ਨਾਲ ਮੰਨਤ ਮੰਨਤ ਮੰਗੋ ਹੱਥ ਜੋੜ ਕੇ ਮ ਮੰਨਤ ਮੰਗੋ ਆਪਣੀ ਮੰਨਤ ਪੂਰੀ ਹੁੰਦੀ ਹੈ ਆਪਣੇ ਸਾਡੇ ਇੱਥੇ ਰਾਜਾ ਸਾਹਿਬ ਗੁਣਾਚੋਰ ਦੇ ਨਾਲੇ ਪਿੰਡ ਮਜ਼ਾਰਾ ਰਾਜਾ ਸਾਹਿਬ ਉੱਥੇ ਉੱਥੇ ਐਤਵਾਰ ਨੂੰ ਪੂਰਾ ਮੇਲਾ ਲੱਗਿਆ ਹੁੰਦਾ ਪੂਰਾ ਮੇਲਾ ਇੰਨੀ ਦੁਨੀਆ ਜਾਂਦੀ ਹੈ ਉੱਥੇ ਜਿੱਦਾਂ ਕੋਈ ਬਾਹਰ ਕਿਸੇ ਨੇ ਬਾਹਰ ਜਾਣਾ ਹੋਵੇ ਸੱਚੇ ਦਿਲ ਨਾਲ ਮੰਗਦਾ ਵੀ ਮੰਨਤ ਮੰਗਦਾ ਵੀ ਰਾਜਾ ਸਾਹਿਬ ਜੀ ਵੀ ਸਾਡੀ ਮੰਨਤ ਪੂਰੀ ਕਰ ਦਿਓ ਅਸੀਂ ਜਹਾਜ਼ ਚੜ੍ਹਾ ਕੇ ਜਾਵਾਂਗੇ ਉਹਨਾਂ ਦਾ ਇਤਿਹਾਸ ਇੱਦਾਂ ਵੀ ਉੱਥੇ ਜਹਾਜ਼ ਚੜ੍ਹਦੇ ਆ ਜਿੱਦਾਂ ਵੀ ਕਿਸੇ ਦਾ ਵੀਜਾ ਨਿਕਲ ਕੇ ਕਿਸੇ ਦਾ ਵੀਜਾ ਆ ਜਾਂਦਾ ਕਿਸੇ ਬਾਹਰਲਾ ਬਣ ਜਾਂਦਾ ਉਹ ਜਹਾਜ਼ ਚੜ੍ਹਾ ਕੇ ਜਾਂਦਾ ਉੱਥੇ ਰਾਜਾ ਸਾਹਿਬ ਇੱਦਾਂ ਜਿਹੜੀ ਬਾਬਾ ਪੀਰ ਦੀ ਜਗ੍ਹਾ ਨਗੱਜੇ ਬਾਬੇ ਪੀਰ ਦੀ ਉੱਥੇ ਟਾਈਮ ਪੀਸ ਚੜ੍ਹਾਏ ਜਾਂਦੇ ਉੱਥੇ ਜੇ ਕੋਈ ਆਪਾਂ ਆਪਣੀ ਮੰਨਤ ਪੂਰੀ ਹੁੰਦੀ ਹੈ ਉੱਥੇ ਟਾਈਮ ਪੀਸ ਚੜ੍ਹਾ ਕੇ ਜਾਂਦੇ ਜੇ ਜੇ ਆਪਾਂ ਕੋਈ ਮੰਨਤ ਮੰਗਦੇ ਹਾਂ ਆਪਣੀ ਪੂਰੀ ਹੁੰਦੀ ਹੈ ਫਿਰ ਉੱਥੇ ਟਾਈਮ ਪੀਸ ਚੜ੍ਹਾਉਂਦੇ ਆ ਬਾਬੇ ਨਗੱਜੇ ਦੀ ਜਗ੍ਹਾ 'ਤੇ ਟਾਈਮ ਪੀਸ ਚੜ੍ਹਾਏ ਜਾਂਦੇ ਆ ਰਾਜਾ ਸਾਹਿਬ ਦੇ ਜਿੱਦਾਂ ਜਹਾਜ਼ ਚੜ੍ਹਾਏ ਜਾਂਦੇ ਆ ਜਿੱਦਾਂ ਬਾਹਰ ਬੁਹਰਲਾ ਬਣ ਗਿਆ ਅਤੇ ਜੇ ਜਹਾਜ਼ ਚੜ੍ਹਾਏ ਲੱਕੜ ਦਾ ਜਹਾਜ਼ ਚੜ੍ਹਾ ਜਾਣਾ ਦੂਜਾ ਜਿਹੜਾ ਹੁੰਦਾ ਹਵਾ ਗੁਬਾਰਾ ਹਵਾ ਭਰਦੇ ਜਿਹੜੇ ਜਹਾਜ਼ ਜਿਹੇ ਜਹਾਜ਼ ਜਿਹੇ 'ਚ ਭਰਦੇ ਨਹੀਂ ਉਹ ਉਹ ਜਹਾਜ਼ ਚੜ੍ਹਾਏ ਜਾਂਦੇ ਸੱਚੇ ਦਿਲ ਨਾਲ ਮ ਸੱਚੇ ਦਿਲ ਨਾਲ ਮੰਗੋ ਹਰੇਕ ਮੰਨਤ ਪੂਰੀ ਹੁੰਦੀ ਦਿਲ ਸਾਫ ਰੱਖਣਾ ਚਾਹੀਦਾ ਆਪਣਾ ਕਦੇ ਵੀ ਆਪਣੇ ਦਿਲ 'ਚ ਮੈਲ ਨਾ ਰੱਖੋ ਨਾ ਕਿਸੇ ਦਾ ਬੁਰਾ ਸੋਚੋ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਹਮੇਸ਼ਾ ਭਲਾ ਹੀ ਕਰੋ ਵੀ ਰੱਬਾ ਸਾਰਿਆਂ ਦਾ ਭਲਾ ਕਰੀਂ ਸੱਚੇ ਦਿਲੋਂ ਮੰਗਣਾ ਚਾਹੀਦਾ ਜੋ ਵੀ ਮੰਗਣਾ ਠੀਕ ਹੈ ਕਦੇ ਵੀ ਆਪਣੇ ਦਿਲ 'ਚ ਮੈਲ ਨਾ ਰੱਖੋ